ਸਭ ਤੋਂ ਇੰਪੋਟੈਂਟ ਗੱਲ ਕਿ ਘਰ ਦੇ ਅੰਦਰ ਦੀ ਸਫਾਈ ਤਾਂ ਆਪਾਂ ਸਾਰੇ ਕਰਦੇ ਹਾਂ ਮੋਸਟਲੀ ਲੋਕ ਕੀ ਕਰਦੇ ਹਨ ਕਿ ਘਰ ਦੇ ਬਾਹਰ ਵਾਲਾ ਜੋ ਏਰੀਆ ਨਾ ਉਹਨੂੰ ਭੁੱਲ ਜਾਂਦੇ ਕਿ ਇਹ ਵੀ ਸਾਡਾ ਹੀ ਏਰੀਆ ਬਾਹਰ ਵਾਲਾ ਘਰ ਤੋ ਬਾਹਰ ਦਾ ਜਿਹੜਾ ਏਰੀਆ ਉਹਨੂੰ ਸਾਫ ਰੱਖਣ ਦੇ ਲਈ ਘਰ ਤੋਂ ਬਾਹਰ ਇੱਕ ਡਸਟਬੀਨ ਰੱਖਿਆ ਜਾਂਦਾ ਹੈ ਤਾਂ ਕਿ ਕਈ ਵਾਰ ਹੁੰਦਾ ਕਿ ਜੋ ਸੜਕ 'ਤੇ ਜਾ ਰਹੇ ਹੈ ਉਹ ਵੀ ਅਗਲਾ ਆਪਣਾ ਰੈਪਰ ਵੀ ਸੁੱਟ ਦਿੰਦਾ ਅਸੀਂ ਵੀ ਕੋਈ ਇਦਾਂ ਦੇ ਜਿਹੜਾ ਕਚਰਾ ਅੰਦਰ ਨਹੀਂ ਰੱਖ ਸਕਦੇ ਉਹਨੂੰ ਅਸੀਂ ਬਾਹਰ ਥਰੋ ਕਰ ਦਿੰਦੇ ਆ ਔਰ ਪਲਾਸਟਿਕ ਦੇ ਲਿਫਾਫੇ ਹੋਗੇ ਬੈਗ ਹੋਗੇ ਉਹਨਾਂ ਨੂੰ ਸੈਪਰੇਟ ਰੱਖਿਆ ਜਾਂਦਾ ਔਰ ਜਿਹੜੀ ਹਰੀਆਂ ਸਬਜ਼ੀਆਂ ਦੇ ਪੱਤੇ ਵਗੈਰਾ ਹੋਗੇ ਉਹਨਾਂ ਨੂੰ ਅਸੀਂ ਸੈਪਰੇਟ ਰੱਖਦੇ ਹਾਂ ਜੋ ਸਾਡੇ ਘਰ ਦੇ ਆਪਣੇ ਰੂਲਸ ਨੇ ਅਸੀਂ ਆਪਣੇ ਘਰ ਦੇ ਬਾਹਰ ਦੀ ਸਾਫ ਸਫਾਈ ਵੱਲ ਵੀ ਪੂਰਾ ਧਿਆਨ ਦਿੰਦੇ ਹਾਂ ਕੋਈ ਵੀ ਰੈਪਰ ਹੈ ਜਾਂ ਕੁਛ ਵੀ ਘਰ ਦਾ ਅੰਦਰ ਵਾਲਾ ਕਚਰਾ ਸੀ ਬਾਹਰ ਨੀ ਥਰੋ ਕਰਦੇ ਮੋਸਟਲੀ ਅਸੀਂ ਦੇਖਦੇ ਹਾਂ ਕਿ ਲੋਕ ਘਰ ਦਾ ਸਾਰਾ ਕਚਰਾ ਲਿਆ ਕੇ ਆਪਣੇ ਘਰ ਤੋਂ ਬਾਹਰ ਸੁੱਟ ਦਿੰਦੇ ਹਨ ਕੀ ਚਲੋ ਅੰਦਰ ਦੀ ਸਫਾਈ ਹੋਗੀ ਬਾਹਰ ਦੇ ਵੀ ਤੱਕ ਸਾਨੂੰ ਕੋਈ ਮਤਲਬ ਨਹੀਂ ਹੈ ਬਟ ਇਹ ਰੋਂਗ ਹੈ ਘਰ ਜਿੰਨੀ ਇੰਪੋਰਟੈਂਸ ਘਰ ਦੇ ਅੰਦਰ ਹੈ ਸਫਾਈ ਦੀ ਉਨੀ ਹੀ ਬਾਹਰ ਹੈ ਇਸ ਲਈ ਸਾਨੂੰ ਸੈਪਰੇਟ ਡਸਟਬਿਨ ਰੱਖਣੇ ਚਾਹੀਦੀ ਹੈ ਤਾਂ ਕਿ ਜਿਹੜਾ ਗਾਰਬੇਜ ਉਠਾਉਣ ਵਾਲੇ ਆ ਉਹਨਾਂ ਨੂੰ ਵੀ ਅੱਗੇ ਆਸਾਨੀ ਹੋਵੇ ਜਦੋਂ ਕਚਰਾ ਅੱਗੇ ਜਾ ਕੇ ਅਲੱਗ ਅਲੱਗ ਕਰਦੇ ਆ ਕਿ ਹਰਾ ਕਚਰਾ ਉਹ ਅਲੱਗ ਕਰਦੇ ਹਨ ਰੈਪਰ ਵਗੈਰਾ ਪਲਾਸਟਿਕ ਵਾਲਾ ਕਚਰਾ ਉਹ ਅਲੱਗ ਕਰਦੇ ਹਨ